ਹੈਲੋ ਹਾਂਜੀ ਤੁਸੀਂ ਹਰਵਿੰਦਰ ਕੌਰ ਬੋਲ ਰਹੇ ਹੋ ਮੈਮ ਮੈਨੂੰ ਨਾ ਰੁਪਿੰਦਰ ਮੈਡਮ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਹਾਂਜੀ ਹਾਂਜੀ ਤੁਸੀਂ ਇਸ ਟਾਈਮ ਮਾਨਸਾ ਵਿੱਚ ਪੜ੍ਹਦੇ ਹੋ ਨਾ ਕੋਲਜ ਹਾਂਜੀ ਮੈਮ ਮੈਂ ਵੀ ਇੱਥੇ ਐਡਮਿਸ਼ਨ ਲਈ ਸੀਗੀ ਹਾਂਜੀ ਮੈਮ ਮੈਨੂੰ ਮੈਂ ਐਕਚੁਲੀ ਕਿਤੋਂ ਹੋਰ ਬਿਲੋਂਗ ਕਰਦੀ ਹਾਂ ਇਸ ਕਰਕੇ ਮੈਨੂੰ ਇਹ ਦੱਸੋਗੇ ਵੀ ਇੱਥੇ ਦਾ ਵੈਦਰ ਕਿਵੇਂ ਦਾ ਏ ਇਸ ਟਾਈਮ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਪਾਣੀ ਵਗੈਰਾ 'ਤੇ ਕੋਈ ਜ਼ਿਆਦਾ ਦਿੱਕਤ ਤਾਂ ਨਹੀਂ ਮੈਡਮ ਇੱਥੇ ਹੈਲੋ ਹਾਂਜੀ ਮੈਮ ਕੀ ਕਹਿ ਰਹੇ ਸੀ ਪਾਣੀ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਕੁਛ ਅੱਛਾ ਜੀ ਅਤੇ ਠੀਕ ਹੈ ਜੀ ਠੀਕ ਮੈਂ ਬਸ ਅਗਲੇ ਹਫਤੇ ਤੱਕ ਆ ਜੂੰਗੀ ਹਾਂਜੀ ਹੋਸਟਲ ਦਾ ਤਾਂ ਹੋ ਗਿਆ ਸੀ ਬਸ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਸੀਗਾ ਕਿ ਮਾਨਸਾ ਦੇ ਵਿੱਚ ਕਿਵੇਂ ਹੈ ਵੈ ਵੈਦਰ ਵਗੈਰਾ ਹੈਲੋ ਹਾਂਜੀ ਚਲੋ ਠੀਕ ਆ ਫਿਰ ਮੈਂ ਆਉਂਦੀ ਹਾਂ ਮੈਡਮ ਮੈਂ ਤੁਹਾਨੂੰ ਆ ਕੇ ਮਿਲਦੀ ਹਾਂ ਠੀਕ ਹੈ ਓਕੇ